ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਮੈਂ ਤੁਹਾਡੇ ਰੈਸਟੋਰੈਂਟ ਤੋਂ ਆਪਣੀ ਮੰਮੀ ਦੇ ਜਨਮਦਿਨ ਲਈ ਸਮਾਨ ਔਡਰ ਕੀਤਾ ਸੀ ਅਤੇ ਜਿਹਦੇ ਵਿੱਚ ਕੇਕ ਅਤੇ ਸ਼ਾਹੀ ਪਨੀਰ ਗੋਲ ਗੱਪੇ ਅਤੇ ਲੈਮਨ ਸੋਡਾ ਅਤੇ ਦਾਲ ਮੱਖਣੀ ਅਤੇ ਰੋਟੀਆਂ ਔਡਰ ਕੀਤੀਆਂ ਸੀ ਜਿਹਦਾ ਸਾਰਾ ਬਿੱਲ ਮੈਂ ਤੁਹਾਨੂੰ ਦੇ ਦਿੱਤਾ ਹੈ ਅਤੇ ਹੁਣ ਜਿਸ ਦਾ ਬਿਲ ਮੈਂ ਤੁਹਾਨੂੰ ਦੇ ਦਿੱਤਾ ਹੈ ਅਤੇ ਇਸ ਲਈ ਮੈਨੂੰ ਮੈਂ ਘਰ ਵਿੱਚ ਪਾਰਟੀ ਨਹੀਂ ਕਰਨੀ ਮੈਂ ਬਾਹਰ ਪਾਰਕ ਵਿੱਚ ਪਾਰਟੀ ਕਰਨੀ ਹੈ ਅਤੇ ਇਸ ਲਈ ਮੈਨੂੰ ਇਹ ਮੁਸ਼ਕਲ ਆ ਰਹੀ ਹੈ ਕਿ ਮੈਂ ਬਾਹਰ ਭ ਬਰਤਨ ਨਹੀਂ ਲੈ ਕੇ ਜਾ ਸਕਦੀ ਇਸ ਲਈ ਮੈਨੂੰ ਡਿਸਪੋਜਲ ਪਲੇਟਾਂ ਚਾਹੀਦੀਆਂ ਹਨ ਅਤੇ ਮੈਂ ਮੈਨੂੰ ਬ ਮੈਨੂੰ ਇੱਕ ਪਲੇਟਸ ਸੈ ਇੱਕ ਪਲੇਟਾਂ ਸੈਟ ਦਿੱਤਾ ਜਾਵੇ ਅਤੇ ਇੱਕ ਗਲਾਸ ਡਿਸਪੋਜਲ ਗਲਾਸ ਅਤੇ ਡਿਸਪੋਜਲ ਚਮਚ ਅਤੇ ਇੱਕ ਕਾਂਟਾ ਸਪੂਨ ਵਗੈਰਾ ਭੇਜੇ ਜਾਣ ਜਿਸਦਾ ਜਿਸ ਲਈ ਤੁਸੀਂ ਘਬਰਾਉ ਨਾ ਮੈਂ ਤੁਹਾਨੂੰ ਇਸ ਦੀ ਪੇਮੈਂਟ ਬਾਅਦ ਵਿੱਚ ਕਰ ਦਵਾਂਗੀ ਬਾਅਦ ਵਿਚ ਕਰ ਦਵਾਂਗੀ ਧੰਨਵਾਦ